ਮੇਰੇ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਵੀ ਹਨ ਅਤੇ ਕਮਜ਼ੋਰੀਆਂ ਵੀ ਹਨ ਜੇ ਸ਼ਕਤੀਆਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਹਰ ਇੱਕ ਕੰਮ ਨੂੰ ਬਹੁਤ ਆਸਾਨੀ ਨਾਲ ਕਰ ਲੈਂਦਾ ਹਾਂ ਅਤੇ ਸਮਝ ਲੈਂਦਾ ਹਾਂ ਅਤੇ ਮੈਂ ਬਚਪਨ ਤੋਂ ਹੀ ਪੜ੍ਹਨ ਵਿੱਚ ਬਹੁਤ ਵਧੀਆ ਸੀ ਅਤੇ ਮੇਰੇ ਦਿਮਾਗ ਵਿੱਚ ਹਰ ਚੀਜ਼ ਬਹੁਤ ਜਲਦੀ ਘਰ ਕਰ ਲੈਂਦੀ ਹੈ ਮੇਰੇ ਘਰ ਵਿੱਚ ਵੀ ਅਤੇ ਮੇਰੇ ਕਈ ਦੋਸਤ ਵੀ ਮੇਰੀ ਸਲਾਹ ਲੈਣਾ ਪਸੰਦ ਕਰਦੇ ਹਨ ਮੇਰੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਵੀ ਹਨ ਮੈਂ ਮਾੜੀ ਮਾੜੀ ਗੱਲ ਤੋਂ ਗੁੱਸਾ ਕਰ ਲੈਂਦਾ ਹਾਂ ਅਤੇ ਘਰ ਵਿੱਚ ਲੜਾਈ ਹੋ ਜਾਂਦੀ ਹੈ ਅਤੇ ਕਈ ਵਾਰ ਮੈਂ ਮੰਮੀ ਡੈਡੀ ਦੀਆਂ ਗੱਲਾਂ ਨੂੰ ਸੀਰੀਅਸ ਵੀ ਨਹੀਂ ਲੈਂਦਾ ਜਿਸ ਕਰਕੇ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹਨ